ਪੇਪਰ ਰਿੰਗ ਇਹ ਕੀ ਹੈ ਇਸ ਇਹ ਇਸ ਕਿਸਮ ਦੀਆਂ ਮਾਰਕ ਆਰਟ ਰਿੰਗਾ ਦੀ ਲੜਾਈ ਦੇ ਆਧਾਰ ਤੇ ਬਣਾਇਆ ਗਿਆ ਹੈ ਮਾਰਕ ਆਸਟ ਦੀਆਂ ਇਸ ਕਿਸਮ ਵਿੱਚ ਬਹੁਤ ਸਾਰੀਆਂ ਲੜਾਈਆਂ ਸਿਧਾਂਤ ਦੀਆਂ ਤਾਲਮੇਲ ਅਤੇ ਤਰੀਕਾਂ ਦੀ ਮਿਲਣ ਨਾਲ ਵਿੱਚ ਸਾਂਭਾ ਫੁੱਟ ਇਸ ਕਿਸ ਤੋਂ ਕਿਸ ਦੀ ਜੂਡੋ ਤੇ ਜੁਸਤ ਦੀਆਂ ਤਕਨੀਕਾਂ ਸ਼ਾਮਿਲ ਹਨ ਖਿਡਾਰੀਆਂ ਦੀ ਤਕਨੀਕ ਇੱਕ ਲੜਾਈ ਵਿਚ ਭੂਮਿਕਾ ਨਿਭਾਉਂਦੀ ਹੈ ਭਾਰ ਭਾਰਤ ਵਰਗ ਦੇ ਭਗੌਤਿਕ ਡਾਟੇ ਵਿੱਚ ਕੋਈ ਫਰਕ ਨਹੀਂ ਪੈਂਦਾ ਦਰਦ ਨਾਕ ਅਤੇ ਸਾਹ ਘੁੱਟਣ ਵਾਲੀਆਂ ਕਮੀਆਂ ਤੇ ਪਾਬੰਦੀਆਂ ਲਗਾਤਾਰ ਲਗਭਗ ਗੈਰ ਹਾਜ਼ਰ ਹੁੰਦੀਆਂ ਹਨ ਜੂਡੋ ਦੀਆਂ ਵਿਸ਼ੇਸ਼ਤਾਵਾਂ ਗਪਲਿੰਗ ਵੱਖ ਵੱਖ ਲੜਾਈਆਂ ਦੇ ਵੱਖੋ ਵਿਸ਼ੇਸ਼ ਤੋ ਵੱਖ ਹਨ ਜੋ ਇਸ ਮਾਮਲੇ ਵਿੱਚ ਜਿੱਤ ਨੂੰ ਤਕਨੀਕ ਸਿਧਾਂਤਾਂ ਦੀ ਵਰਤੋਂ ਨਾਲ ਨਹੀਂ ਤਹਿ ਕੀਤੇ ਜਾਂਦੇ ਹਨ ਪਰ ਦੁਖਦਾਇਕ ਅਤੇ ਘੁੰਮਣ ਘੁੰਮਣ ਘੁਟਨ ਦੇ ਉਪਯੋਗ ਕਰਕੇ ਇਸ ਕਿਸਮ ਦੀਆਂ ਸੰਘਾਰਸ਼ਾ ਦੇ ਨਾਲ ਇੱਕ ਹੋਰ ਗੁਨਾ ਅਥਲੈਟਿਕ ਦਾ ਰੂਪ ਹੈ ਕੱਪੜੇ ਦਾ ਇੱਕ ਸਮੂਹ ਸ਼ਾਟ ਨੂੰ ਛੱਡ ਕੇ ਰੇਸ਼ੇਦਾਰ ਥੋੜਾ ਜਾ ਲੰਮਾ ਵਚੀਲਾ ਤੰਗ ਫਿਟ ਟੀ ਸ਼ਰਟ ਵੀ ਸ਼ਾਮਿਲ ਹਨ ਤਕਨੀਕ ਨਾਲ ਅੱਜ ਲੜਨ ਦੀ ਕਲਾ ਹੈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਇਸ ਤਰ੍ਹਾਂ ਦੀਆਂ ਲੜਾਈਆਂ ਨੂੰ ਵਿਸ਼ੇਸ਼ ਸਟਾਲ ਲੜਾਈਆਂ ਵੀ ਕਿਹਾ ਜਾਂਦਾ ਹੈ ਕਰੀਬ ਸੱਤਰ ਪ੍ਰਤੀਸ਼ਤ ਸੜਕਾਂ ਦੀ ਲੜਾਈ ਜਮੀਨ ਤੇ ਇੱਕ ਲੜਾਈ ਵਿੱਚ ਖਤਮ ਹੋ ਜਾਂਦੀ ਹੈ